ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਆਪਣੀਆਂ ਜੜਾਂ ਨਾਲ ਜੋੜਨ ਨੂੰ ਯਕੀਨੀ ਬਣਾਉਣ ਲਈ ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਅਤੇ ਪ੍ਰਫੁੱਲਿਤ ਕਰਨਾ ਜਰੂਰੀ ਹੈ ਸਿੱਖਿਆ ਸਕੂਲੀ ਪਾਠਕਰਮ ਵਿੱਚ ਪੰਜਾਬੀ ਭਾਸ਼ਾ ਦੇ ਕੋਰਸ ਸ਼ਾਮਿਲ ਕਰਨਾ ਮੁਢਲੀ ਸਿੱਖਿਆ ਤੋਂ ਲੈ ਉੱਚ ਸਿੱਖਿਆ ਤੱਕ ਯਕੀਨੀ ਬਣਾਓ ਕਿ ਵਿਦਿਆਰਥੀਆਂ ਕੋਲ ਮਿਆਰੀ ਅਧਿਆਪਣ ਸਰੋਤਾਂ ਅਤੇ ਸਿਖਲਾਈ ਪ੍ਰਾਪਤ ਸਿੱਖਿਆਕਾਂ ਤੱਕ ਪਹੁੰਚ ਹੈ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਦੂਜੀ ਭਾਸ਼ਾ ਵਜੋਂ ਪੜਾਉਣ ਲਈ ਸਮਰਪਿਤ ਪੰਜਾਬੀ ਭਾਸ਼ਾ ਸੰਸਸਥਾਵਾਂ ਅਤੇ ਸਕੂਲਾਂ ਦਾ ਸਮਰਥਨ ਅਤੇ ਸਥਾਪਨਾ ਕਰਨਾ ਮੀਡੀਆ ਅਤੇ ਟੈਕਨੋਲਜੀ ਡਿਜੀਟਲ ਮੌਜੂਦਗੀ ਵੈਬਸਾਈਟਾਂ ਸੋਸ਼ਲ ਮੀਡੀਆ ਅਤੇ ਐਪਾਂ ਰਾਹੀਂ ਆਨਲਾਈਨ ਪੰਜਾਬੀ ਸਮੱਗਰੀ ਦਾ ਪ੍ਰਚਾਰ ਕਰੋ ਵਲੋਗ ਵੀਡੀਓਜ ਅਤੇ ਪੋਡਕਾਸਟਾਂ ਸਮੇਤ ਪੰਜਾਬੀ ਭਾਸ਼ਾ ਦੀ ਸਮੱਗਰੀ ਬਣਾਉਣ ਲਈ ਉਤਸ਼ਾਹਿਤ ਕਰੋ ਮੀਡੀਆ ਪਰੋਡਕਾਸਟ ਪੰਜਾਬੀ ਟੈਲੀਵਿਜ਼ਨਾਂ ਚੈਨਲਾਂ ਰੇਡੀਓ ਸਟੇਸ਼ਨ ਅਤੇ ਪ੍ਰਿੰਟ ਮੀਡੀਆ ਦਾ ਸਮਰਥਨ ਕਰੋ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਸੰਗੀਤ ਅਤੇ ਸਾਹਿਤ ਵਿੱਚ ਨਿਵੇਸ਼ ਕਰੋ ਤਾਂ ਜੋ ਭਾਸ਼ਾ ਨੂੰ ਜੀਵਤ ਅਤੇ ਪ੍ਰਸੰਗਿਤ ਬਣਾਈ ਜਾ ਸਕੇ ਸੱਭਿਆਚਾਰ ਸਮਾਗਮ ਸੱਭਿਆਚਾਰਕ ਸਮਾਗਮ ਤਿਉਹਾਰ ਅਤੇ ਭਾਸ਼ਾ ਦਿਵਸ ਦਾ ਆਯੋਜਨ ਕਰੋ ਜਿੱਥੇ ਪੰਜਾਬੀ ਪ੍ਰਮੁੱਖ ਤੌਰ ਤੇ ਵਰਤੀ ਜਾਂਦੀ ਹੈ ਕਹਾਣੀ ਸੁਣਾਉਣ ਕਵਿਤਾ ਅਤੇ ਪਰੰਪਰਾ ਪ੍ਰਦਰਸ਼ਨਾ ਰਾਹੀਂ ਸੱਭਿਆਚਾਰਕ ਭਾਗੀਦਾਰੀ ਨੂੰ ਉਤਸਾਹਿਤ ਕਰੋ ਭਾਸ਼ਾ ਕਲੱਬਾਂ ਅਤੇ ਐਸੋਸੀਏਸ਼ਨਾਂ ਪੰਜਾਬੀ ਭਾਸ਼ਾ ਤੇ ਸਾਹਿਤ ਧਿਆਨ ਕੇਂਦਰਿਤ ਕਰਨ ਵਾਲੇ ਕਲੱਬਾਂ ਅਤੇ ਐਸੋਸੀਏਸ਼ਨਾਂ ਦੀ ਸਥਾਪਨਾ ਜਾਂ ਸਮਰਥਨ ਕਰੋ ਇਹ ਭਾਸ਼ਾ ਸਿੱਖਣ ਅਭਿਆਸ ਅਤੇ ਜਸ਼ਨ ਮਸ਼ਾ ਜਸ਼ਨ ਮਨਾਉਣ ਲਈ ਕੇਂਦਰਾਂ ਵਜੋਂ ਕੰਮ ਕਰ ਸਕਦੇ ਹਨ ਸਰਕਾਰੀ ਸਹਾਇਤਾ ਨੀਤੀ ਅਤੇ ਫੰਡਿੰਗ ਸਰਕਾਰੀ ਨੀਤੀਆਂ ਅਤੇ ਫੰਡਿੰਗ ਲਈ ਐਡਵੋਕੇਟ ਜੋ ਪੰਜਾਬੀ ਦੀ ਸੰਭਾਲ ਅਤੇ ਪ੍ਰਚਾਰ ਦਾ ਸਮਰਥਨ ਕਰਦੇ ਹਨ ਇਸ ਵਿੱਚ ਪੰਜਾਬੀ ਭਾਸ਼ਾ ਦੇ ਪ੍ਰੋਗਰਾਮਾਂ ਲਈ ਗਰਾਟਾਂ ਅਤੇ ਪੰਜਾਬੀ ਦੀ ਵਰਤੋਂ ਕਰਨ ਵਾਲੇ ਕਾਰੋਬਾਰਾਂ ਦੀ ਪ੍ਰੋਤਸਾਹਨ ਸ਼ਾਮਿਲ ਹਨ ਪੰਜਾਬੀ ਦੀ ਸੁਰੱਖਿਆ ਅਤੇ ਪ੍ਰਫੁੱਲਤ ਕਰਨ ਲਈ ਇੱਕ ਬਹੁਪੱਖੀ ਪਹੁੰਚ ਦੀ ਲੋੜ ਹੈ ਜਿਸ ਵਿੱਚ ਸਿੱਖਿਆ ਅਤੇ ਦਿਲਚਸਪ ਮੌਕੇ ਪੈਦਾ ਕਰਕੇ ਰੋਜਾਨਾ ਜੀਵਨ ਸਭ ਸੱਭਿਆਚਾਰ ਵਿੱਚ ਪੰਜਾਬੀ ਨੂੰ ਜੋੜ ਕੇ ਇਹ ਯਕੀਨੀ ਬਣਾਉਣ